ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਰਿਹਾਇਸ਼ੀ ਵਿਕਲਪ ਬਹੁਤ ਹਨ ਜੇ ਗੱਲ ਗੱਲ ਕਰੀਏ ਜਿੱਦਾਂ ਕਿ ਬਾਹਰ ਤੋਂ ਲੋਕ ਆਉਂਦੇ ਨੇ ਇੱਥੇ ਰਹਿੰਦੇ ਨੇ ਉਹ ਛੋਟੇ ਮਕਾਨ ਵਿੱਚ ਵੀ ਰਹਿੰਦੇ ਨੇ ਜਿੱਦਾਂ ਇੱਕ ਬੈਡਰੂਮ ਹੁੰਦਾ ਜਿਹਦੇ ਵਿੱਚ ਜਿਹੜੇ ਫੈਮਲੀ ਨਾਲ ਆਉਂਦੇ ਨੇ ਉਹਨਾਂ ਨੂੰ ਪੂਰੀ ਵੀ ਜਿੱਦਾਂ ਪੂਰਾ ਰੂਮ ਸ ਰੂਮ ਦੋ ਰੂਮ ਦਾ ਹੋ ਗਿਆ ਇੱਕ ਕਿਚਨ ਹੋ ਗਿਆ ਇੱਦਾਂ ਦਾ ਇਹ ਸਾਰਾ ਫਲੈਟ ਵਗੈਰਾ ਹੁੰਦਾ ਉਹ ਵੀ ਮਿਲ ਜਾਂਦਾ ਇੱਥੇ ਜੇ ਗੱਲ ਕਰੀਏ ਜਿੱਦਾਂ ਹੁਣ ਜਿਹਦੀ ਪੋਸਟਿੰਗ ਇੱਧਰ ਨਵੇਂ ਸ਼ਹਿਰ ਵਿੱਚ ਹੁੰਦੀ ਹੈ ਜਿੱਦਾਂ ਬਾਹਰ ਤੋਂ ਆਉਂਦੇ ਨੇ ਜਿੱਦਾਂ ਅੰਮ੍ਰਿਤਸਰ ਤੋਂ ਹੋ ਗਿਆ ਜਲੰਧਰ ਤੋਂ ਹੋ ਗਿਆ ਇੱਦਾਂ ਦੂਰ ਦੂਰ ਏਰੀਏ ਤੋਂ ਪੈ ਜਾਂਦੇ ਨੇ ਨਾ ਉਹਨਾਂ ਨੂੰ ਫਿਰ ਆਪਣੀ ਫੈਮਲੀ ਨਾਲ ਕੋਈ ਨਾ ਕੋਈ ਘਰ ਵਗੈਰਾ ਦੇਖਣਾ ਪੈਂਦਾ ਹੈ ਉਹ ਵੈਸੇ ਉਹਨਾਂ ਨੂੰ ਮਿਲ ਜਾਂਦਾ ਸੱਤ ਅੱਠ ਹਜ਼ਾਰ ਤੱਕ ਮਿਲ ਜਾਂਦਾ ਬਟ ਜਿੱਦਾਂ ਪਿੰਡ ਵਿੱਚ ਨੂੰ ਚਲੇ ਜਾਈਏ ਤਾਂ ਪੰਜ ਕੁ ਹਜ਼ਾਰ ਤੱਕ ਵੀ ਮਿਲ ਜਾਂਦਾ ਜੇ ਹੁਣ ਜਿਹੜੇ ਪੜ੍ਹਨ ਲੋਕ ਆਉਂਦੇ ਨੇ ਜਿੱਦਾਂ ਬੱਚੇ ਆਉਂਦੇ ਨੇ ਸਟੂਡੈਂਟ ਬਹੁਤ ਆਉਂਦੇ ਨੇ ਇੱਥੇ ਇੱਥੇ ਕੋਲਜ ਬਹੁਤ ਹੈਗੇ ਨੇ ਉਹਨਾਂ ਵਿੱਚ ਵੀ ਇੱਦਾਂ ਹੀ ਹੈ ਵੈਸੇ ਤਾਂ ਪੀ ਜੀ ਮਿਲ ਜਾਂਦਾ ਸਕੂਲ ਕੋਲਜਾਂ ਵਿੱਚ ਜੇ ਬੱਚੇ ਨੇ ਪੀ ਜੀ ਨਹੀਂ ਵਿੱਚ ਰਹਿਣਾ ਤਾਂ ਹੋਸਟਲ ਹੈਗੇ ਹੋਸਟਲ ਹੁੰਦੇ ਨੇ ਕ ਕੋਲਜਾਂ ਵਿੱਚ ਜੇ ਉਹ ਕੋਲਜਾਂ 'ਚ ਹੋਸਟਲ ਵਿੱਚ ਨਹੀਂ ਰਹਿਣਾ ਤਾਂ ਫਿਰ ਪੀ ਜੀ 'ਚ ਆ ਜਾਂਦੇ ਨੇ ਪੀ ਜੀ ਵਿੱਚ ਵੀ ਇੱਦਾਂ ਹੀ ਹੁੰਦਾ ਵੀ ਤਿੰਨ ਚਾਰ ਬੱਚੇ ਹੁੰਦੇ ਨੇ ਇੱਕ ਰੂਮ ਵਿੱਚ ਉਹੀ ਇੱਕ ਇੱਕ ਬੈਡ ਹੁੰਦਾ ਉਹਨਾਂ ਨੂੰ ਅਲਮਾਰੀ ਮਿਲਦੀ ਹੈ ਉਹ ਪੂਰਾ ਸੈਟ ਹੁੰਦਾ ਅਤੇ ਖਾਣ ਪੀਣ ਦਾ ਜਿਹੜਾ ਹੁੰਦਾ ਉਹ ਸਾਰਾ ਜਿਹੜਾ ਘਰ ਦਾ ਮਾਲਕ ਹੁੰਦਾ ਜਾਂ ਤਾਂ ਉਹਦੇ ਸਿਰ 'ਤੇ ਹੁੰਦਾ ਜੇ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਰਹਿਣ ਲੱਗ ਜਾਂਦੇ ਨੇ ਤਾਂ ਉਹ ਆਪ ਵੀ ਬਣਵਾ ਲੈਂਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਵੈਸੇ ਤਾਂ ਫਾਇਦਾ ਹੋ ਉਹਦੇ ਵਿੱਚ ਹੀ ਹੁੰਦਾ ਅਤੇ ਕਈ ਵਾਰ ਹੁੰਦਾ ਵੀ ਬੱਚਿਆਂ ਕੋਲ ਟਾਈਮ ਨਹੀਂ ਹੁੰਦਾ ਤਾਂ ਜਿਹੜਾ ਮਕਾਨ ਦਾ ਮਾਲਿਕ ਹੁੰਦਾ ਉਹ ਆਪਣੇ ਆਪ ਆਪ ਵੀ ਬਣਵਾ ਕੇ ਦੇ ਦਿੰਦਾ ਆਪਣੇ ਵੱਲ ਤੋਂ ਜੇ ਗੱਲ ਕਰੀਏ ਤਾਂ ਕਿਰਾਏ ਦੀ ਕਿਰਾਇਆ ਉਹਨਾਂ ਨੂੰ ਚਾਰ ਚਾਰ ਜਾਂ ਪੰਜ ਹਜ਼ਾਰ ਤੱਕ ਇੰਨੇ ਤੱਕ ਪੈ ਜਾਂਦਾ